ਪੰਜਾਬੀ ਭਾਸ਼ਾ ਇੱਕ ਇੰਡੋ ਆਰਿਅਨ ਭਾਸ਼ਾ ਹੈ ਜੋ ਕਿ ਦੇਸ਼ ਭਰ ਦੇ ਲੋਕਾਂ ਵੱਲੋਂ ਬੋਲੀ ਜਾਂਦੀ ਹੈ ਇਹ ਇੱਕ ਦਫਤਰੀ ਭਾਸ਼ਾ ਹੈ ਜੋ ਕਿ ਪੰਜਾਬ ਹਰਿਆਣਾ ਦਿੱਲੀ ਰਾਜਾਂ ਵਿੱਚ ਬੋਲੀ ਜਾਂਦੀ ਹੈ ਕਨੇਡਾ ਅਮਰੀਕਾ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਤੀਸਰਾ ਸਥਾਨ ਮਿਲਿਆ ਹੋਇਆ ਹੈ ਸਿੱਖਾਂ ਦਾ ਮਹਾਨ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਇਸ ਭਾਸ਼ਾ ਵਿੱਚ ਲਿਖਿਆ ਹੋਇਆ ਹੈ ਦੱਖਣੀ ਏਸ਼ੀਆ ਦੀ ਭਾਸ਼ਾਵਾਂ ਤੋਂ ਪ੍ਰਭਾਵਿਤ ਹੋ ਕੇ ਇਹ ਭਾਸ਼ਾ ਲਿਖੀ ਗਈ ਹੈ ਇਸ ਵਿੱਚ ਇੱਕ ਅਲੱਗ ਤਰ੍ਹਾਂ ਦੀ ਧੁਨੀ ਵਰਤੀ ਗਈ ਹੈ ਇਸ ਭਾਸ਼ਾ ਦੀ ਵਰਤੋਂ ਨਾਲ ਇਤਿਹਾਸ ਕਵਿਤਾਵਾਂ ਅਤੇ ਸ਼ੇਰੋ ਸ਼ਾਇਰੀ ਲਿਖੀ ਗਈ ਹੈ ਪੰਜਾਬ ਦਾ ਕਲਚਰ ਇਸ ਭਾਸ਼ਾ ਦੇ ਸਾਂਭਿਆ ਹੋਇਆ ਹੈ ਪੰਜਾਬੀ ਕਲਚਰ 'ਚ ਭੰਗੜੇ ਅਤੇ ਗਿੱਧਿਆਂ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਇਸ ਭਾਸ਼ਾ ਵਿੱਚ ਬੋਲੀ ਜਾਂਦੀ ਹੈ ਪੰਜਾਬ ਦੇ ਮਹਾਨ ਕਵੀ ਬੁੱਲ੍ਹੇ ਸ਼ਾਹ ਵਾਰਸ਼ ਸ਼ਾਹ ਇਸ ਭਾਸ਼ਾ ਕਰਕੇ ਮਸ਼ਹੂਰ ਹਨ ਪੰਜਾਬੀ ਫਿਲਮਾਂ ਵਿੱਚ ਵੀ ਪੰਜਾਬੀ ਭਾਸ਼ਾ ਹੀ ਬੋਲੀ ਜਾਂਦੀ ਹੈ ਜਿਸ ਨੂੰ ਪੋਲੀਵੁੱਡ ਕਿਹਾ ਗਿਆ ਹੈ ਸਰਕਾਰੀ ਕਾਰਜਕਾਰਾਂ 'ਚ ਥਾਵਾਂ 'ਤੇ ਵੀ ਇਸ ਭਾਸ਼ਾ ਦਾ ਇਸਤੇਮਾਲ ਕੀਤਾ ਜਾਂਦਾ ਹੈ ਪੰਜਾਬ ਦੇ ਸਕੂਲ ਅਤੇ ਕੋਲਜਾਂ 'ਚ ਉਚੇਚੇ ਤੌਰ 'ਤੇ ਇਹ ਭਾਸ਼ਾ ਬੋਲਣੀ ਅਤੇ ਪੜ੍ਹਨੀ ਸਿਖਾਈ ਜਾਂਦੀ ਹੈ ਪੰਜਾਬੀ ਭਾਸ਼ਾ ਨੇ ਪੂਰੇ ਸੰਸਾਰ 'ਚ ਆਪਣਾ ਅਲੱਗ ਹੀ ਸਥਾਨ ਬਣਾ ਰੱਖਿਆ ਹੈ